ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਭੂਗੋਲਿਕ ਸਿੱਖਿਆ ਨਾਲ਼ ਆਪਣੇ ਰਾਜਾਂ ਬਾਰੇ ਜ਼ਿਆਦਾ ਜਾਣਕਾਰੀ ਮਿਲਦੀ ਹੈ ਅਤੇ ਜ਼ਿਆਦਾ ਪਤਾ ਲੱਗਦਾ ਹੈ